ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਵੈਬਸਾਈਡ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਇੱਕ ਮੋਬਾਈਲ ਫ਼ੋਨ ਔਡਰ ਕੀਤਾ ਸੀ ਅਤੇ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਮੇਰੀ ਬੁਕਿੰਗ ਡੇਟ ਤੋਂ ਹਫ਼ਤੇ ਦੇ ਵਿੱਚ ਵਿੱਚ ਮੇਰੇ ਕੋਲ ਫ਼ੋਨ ਪਹੁੰਚਦਾ ਹੋ ਜਾਵੇਗਾ ਪ੍ਰੰਤੂ ਇਹ ਫ਼ੋਨ ਮੈਨੂੰ ਤਕਰੀਬਨ ਅੱਜ ਮਹੀਨੇ ਬਾਅਦ ਹੱਥ ਲੱਗਿਆ ਹੈ ਪ੍ਰੰਤੂ ਜਦੋਂ ਮੈਂ ਇਸ ਦੀ ਪੈਕਿੰਗ ਖੋਲ੍ਹ ਕੇ ਦੇਖੀ ਤਾਂ ਮੈਂ ਨਿਰਾਸ਼ ਹੋ ਗਿਆ ਕਿਉਂਕਿ ਜਿਹੜਾ ਫ਼ੋਨ ਦਾ ਰੰਗ ਮੈਂ ਮੰਗਵਾਇਆ ਸੀ ਉਹ ਇਹ ਨਹੀਂ ਸੀ ਅਤੇ ਚੱਲੋ ਖੈਰ ਕੋਈ ਨਹੀਂ ਮੈਂ ਫ਼ੋਨ ਔਨ ਕਰਕੇ ਦੇਖਿਆ ਅਤੇ ਜਦੋਂ ਫ਼ੋਨ ਔਨ ਕੀਤਾ ਉਹਨੂੰ ਔਨ ਹੋਣ ਨੂੰ ਹੀ ਪੰਜ ਮਿੰਟ ਲੱਗ ਗਏ ਅਤੇ ਚੱਲੋ ਮੈਂ ਚਾਰਜਿੰਗ 'ਤੇ ਲਾਇਆ ਫ਼ੋਨ ਅਤੇ ਫ਼ੋਨ ਜਦੋਂ ਔਨ ਹੋ ਗਿਆ ਅਤੇ ਫ਼ੋਨ ਦੀ ਨਾ ਸਕਰੀਨ ਦੇ ਉੱਤੇ ਕਾਲੇ ਨਿਸ਼ਾਨ ਆ ਰਹੇ ਸੀ ਅਤੇ ਫਿਰ ਮੈਂ ਇਕਦਮ ਡਰ ਗਿਆ ਕਿ ਮੈਂ ਇੰਨੇ ਪੈਸੇ ਖ਼ਰਚ ਵੀ ਕੀਤੇ ਨੇ ਅਤੇ ਇਹ ਕੀ ਹੋ ਰਿਹਾ ਹੈ ਅਤੇ ਫ਼ੋਨ ਵਾਰ ਵਾਰ ਲੈਗ ਕਰ ਰਿਹਾ ਸੀ ਕੁਝ ਸਾਫਟਵੇਅਰ ਸਨ ਚਲਦੇ ਚਲਦੇ ਬੰਦ ਹੋ ਜਾਂਦੇ ਸਨ ਕਾਲੀ ਸਕਰੀਨ ਹੋ ਰਹੀ ਸੀ ਅਤੇ ਕੈਮਰਾ ਵੀ ਜਦੋਂ ਔਨ ਕਰਦਾ ਸਾਂ ਤਾਂ ਉਹ ਦੋ ਮਿੰਟ ਚੱਲਦਾ ਸੀ ਦੋ ਮਿੰਟ ਚਲਦੇ ਚਲਦੇ ਜਿਹੜੀ ਫੋਟੋ ਖਿੱਚੀ ਹੁੰਦੀ ਸੀ ਉਹ ਉੱਥੇ ਹੀ ਰੁੱਕੀ ਰਹਿੰਦੀ ਸੀ ਮਤਲਬ ਫ਼ੋਨ ਅੱਗੇ ਕੰਮ ਨਹੀਂ ਸੀ ਕਰਦਾ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਜੋ ਮੇਰਾ ਫ਼ੋਨ ਸੀ ਉਹ ਰੀਪਲੇਸ ਕਰ ਦੇਵੋ ਜਿਹੜਾ ਫ਼ੋਨ ਮੈਂ ਮੰਗਵਾਇਆ ਸੀ ਉਹ ਮੈਨੂੰ ਮਿਲਣਾ ਚਾਹੀਦਾ ਹੈ ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਕ੍ਰਿਪਾ ਕਰਕੇ ਮੇਰੇ ਪੈਸੇ ਰੀਫੰਡ ਕਰ ਦਿੱਤੇ ਜਾਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ